ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਕਿਵੇਂ ਹੋ ਤੁਸੀਂ ਸਰ ਤੁਸੀਂ ਇੰਟਰਪ੍ਰਾਈਸਿਸ ਸ਼ੌਪ ਤੋਂ ਗੱਲ ਕਰਦੇ ਪਏ ਹਾਂ ਹਾਂਜੀ ਸਰ ਮੈਂ ਨਾ ਤੁਹਾਡਾ ਤੁਹਾਡੀ ਸ਼ੋਪ ਤੋਂ ਮੋਬਾਇਲ ਖਰੀਦਿਆ ਸੀ ਅਤੇ ਮੋਬਾਇਲ ਬਹੁਤ ਹੀ ਵਧੀਆ ਜਿਵੇਂ ਦੇਖਣ ਵਿੱਚ ਲੱਗਦਾ ਸੀ ਜਦੋਂ ਖੋਲਿਆ ਤਾਂ ਬਹੁਤ ਹੀ ਵਧੀਆ ਸਰ ਅਤੇ ਮੋਬਾਈਲ ਦੀ ਕੁਆਲਿਟੀ ਮੋਬਾਇਲ ਦਾ ਫ਼ੋਨ ਕਵਰ ਸਪੀਕਰ ਅਤੇ ਜੋ ਉਹਦੇ ਵਿੱਚ ਪ੍ਰੋਸੈਸਿੰਗ ਸਾਰਾ ਸਰ ਬਹੁਤ ਵਧੀਆ ਫ਼ੋਨ ਦੇਖਣ ਵਿੱਚ ਸਰ ਬਹੁਤ ਹੀ ਵਧੀਆ ਰੀਹਾ ਧੰਨਵਾਦ ਸਰ